ਹਾਂ ਖਾਣਾ ਬਣਾਉਂਦੇ ਟਾਈਮ ਬਹੁਤ ਆਫਤ ਆਈ ਹੈ ਇੱਕ ਦਿਨ ਤਾਂ ਸਿਲੰਡਰ ਖਤਮ ਹੋ ਗਿਆ ਮੇਰਾ ਟਾਈਮ 'ਤੇ ਉੱਤੋਂ ਆਏ ਹੋਏ ਸੀ ਪ੍ਰਾਹੁਣੇ ਸਿਲੰਡਰ ਖਤਮ ਹੋ ਗਿਆ ਤਾਂ ਹੁਣ ਸਿਲੰਡਰ ਦਾ ਨਾ ਚੁੱਲ੍ਹਾ ਨਾ ਚੁੱਲੇ 'ਚ ਲੱਕੜਾਂ ਪਹਿਲਾਂ ਚੁੱਲ੍ਹਾ ਬਣਾਇਆ ਫਿਰ ਲੱਕੜਾਂ ਲਿਆਉਂਦੀਆਂ ਫਿਰ ਕਿਤੇ ਜਾ ਕੇ ਮੈਂ ਚੁੱਲ੍ਹਾ ਬਾਲਿਆ ਅਤੇ ਉੱਤੋਂ ਇੰਨੀ ਅੰਤਾਂ ਦੀ ਗਰਮੀ ਗਰਮੀ ਕਰਕੇ ਮੇਰਾ ਬੁਰਾ ਹਾਲ ਮਸਾਂ ਪ੍ਰਾਹੁਣਿਆਂ ਨੂੰ ਖਾਣਾ ਬਣਾ ਕੇ ਦਿੱਤਾ ਇੰਨਾਂ ਮੁਸ਼ਕਿਲ ਆਈ ਮੁਸ਼ਕਿਲ ਬਹੁਤ ਜ਼ਿਆਦਾ ਆਈ ਗਰਮੀ 'ਚ ਖਾਣਾ ਬਣਾਉਂਦੇ ਟਾਈਮ ਮੇਰਾ ਉੱਤੋਂ ਪਸੀਨਾ ਚੋਵੇ ਉੱਤੋਂ ਇੰਨੀ ਧੁੱਪ ਅਤੇ ਉੱਤੋਂ ਗਰਮੀ ਸਿਲੰਡਰ ਨਾ ਮਿਲਿਆ ਕਿਤੋਂ ਵੀ ਪਰ ਸਿਲੰਡਰ ਦੀ ਆਫਤ ਆ ਗਈ ਇੱਕ ਦਿਨ ਸਿਲੰਡਰ ਦਾ ਬੁਰਾ ਹਾਲ ਹੈ ਖਾਣਾ ਬਣਾਉਂਦੇ ਟਾਈਮ ਇੱਦਾਂ ਦੀ ਕੋਈ ਆਫਤ ਆ ਜੇ ਤਾਂ ਬਸ ਦੌਰਾ ਪੈਣ ਵਰਗਾ ਹੋ ਜਾਂਦਾ